ਤਕਨੋਲਜੀ ਜਿਵੇਂ ਕਿ ਸ਼ੋਸ਼ਲ ਮੀਡੀਆ 'ਤੇ ਔਨਲਾਈਨ ਡਾਂਸ ਟਟੋਰੀਲੀਅਨ ਨੇ ਡਾਂਸ ਦੇ ਉਦਯੋਗ ਨੂੰ ਕਾਫੀ ਵਧੀਆ ਤਰੀਕੇ ਨਾਲ ਪ੍ਰਭਾਵਿਤ ਕੀਤਾ ਪਹਿਲਾਂ ਤਾਂ ਜਿਵੇਂ ਲ ਅੱਧੇ ਲੋਕ ਪਿੰਡਾਂ ਵਿੱਚ ਰਹਿੰਦੇ ਨੇ ਉੱਥੇ ਤਾਂ ਉਹਨਾਂ ਨੂੰ ਕਾਫੀ ਮੌਕੇ ਵੀ ਨਹੀਂ ਪ੍ਰਦਾਨ ਹੁੰਦੇ ਕਿ ਉਹ ਕਿਸੇ ਵੀ ਵਧੀਆ ਇੰਸਟੀਊਟ ਤੋਂ ਡਾਂਸ ਦੀ ਕੋਚਿੰਗ ਪ੍ਰਾਪਤ ਕਰ ਸਕਣ ਹੈ ਨਾ ਹੁਣ ਜਿਵੇਂ ਜਿਵੇਂ ਕਿ ਤਕਨੋਲਜੀ ਵਧ ਰਹੀ ਹੈ ਉਹਨਾਂ ਨੂੰ ਯੂਟਿਊਬ ਅਤੇ ਹੋਰ ਕਾਫੀ ਸਾਰੇ ਵਿਕੀਪੀਡੀਆ ਤੋਂ ਹੈ ਨਾ ਡਾਂਸ ਦੀ ਜਾਣਕਾਰੀ ਮਿਲਦੀ ਹੈ ਜਿਹਦੇ ਨਾਲ ਕਿ ਓਹਨਾਂ ਨੇ ਡਾਂਸ ਟਟੋਰੀਅਲ ਕਾਫੀ ਵਧੀਆ ਢੰਗ ਨਾਲ ਸਿੱਖੇ ਨੇ ਅਸੀਂ ਆਪਣੇ ਘਰ ਬੈਠੇ ਹੀ ਕਾਫੀ ਤਰ੍ਹਾਂ ਦਾ ਡਾਂਸ ਟੀਟੋਰੀਅਲ ਹੈ ਜਿਹੜੇ ਕਿ ਦੇਖ ਸਕਦੇ ਹਾਂ ਹੈ ਨਾ ਚਾਹੇ ਅਸੀਂ ਕੈਨੇਡੀਅਨ ਡਾਂਸ ਸਿੱਖਣਾ ਹੋਵੇ ਬੈਲੀ ਡਾਂਸ ਸਿੱਖਣਾ ਹੋਵੇ ਅਮੈਰੀਕਨ ਡਾਂਸ ਸਿੱਖਣਾ ਹੋਵੇ ਕੋਈ ਵੀ ਤਰੀਕੇ ਦਾ ਕੋਈ ਵੀ ਢੰਗ ਦਾ ਸਾਨੂੰ ਡਾਂਸ ਸਿੱਖਣਾ ਹੋਵੇ ਤਾਂ ਅਸੀਂ ਇਹ ਤਕਨੋਲਜੀ ਤੋਂ ਪ੍ਰਾਪਤ ਕਰ ਸਕਦੇ ਹਾਂ ਇਹਦੇ ਨਾਲ ਕੀ ਸਾਡੇ ਪੈਸੇ ਦੀ ਅਤੇ ਸ ਸਮੇਂ ਦੀ ਦੋਨਾਂ ਚੀਜ਼ਾਂ ਦੀ ਕਾਫੀ ਬੱਚਤ ਹੁੰਦੀ ਹੈ ਇਹਦੇ ਨਾਲ ਅਸੀਂ ਟਰਾਂਸਪੋਰਟ ਦੀ ਵੀ ਨਹੀਂ ਸਾਨੂੰ ਜ਼ਰੂਰਤ ਪੈਂਦੀ ਅਸੀਂ ਸਿੱਧਾ ਯੂਟਿਊਬ 'ਤੇ ਔਨਲਾਈਨ ਸਰਚ ਕਰਦੇ ਹਾਂ ਅਤੇ ਸਾਡੇ ਕੋਲ ਸਾਰਾ ਡਾਂਸ ਦਾ ਟਟੋਰੀਅਲ ਹੈ ਜਿਹੜਾ ਕਿ ਉਹ ਸਾਰਾ ਸਾਹਮਣੇ ਆ ਜਾਂਦਾ ਇਹਨੇ ਇਸਨੂੰ ਡਾਂਸ ਦੇ ਉਦਯੋਗ ਨੂੰ ਕਾਫੀ ਹੀ ਵਧੀਆ ਢੰਗ ਨਾਲ ਕਹਿ ਜਿਹੜਾ ਕਿ ਉਹ ਪ੍ਰਭਾਵਿਤ ਕੀਤਾ